ਹੈਲੋ ਸਤਿ ਸ਼੍ਰੀ ਅਕਾਲ ਮੈਂ ਅਰੁਨਾ ਤੁਹਾਡਾ ਇੱਥੇ ਪੰਜਾਬ ਵਿੱਚ ਮੇਲਿਆਂ ਦਾ ਰਾਜਾ ਹੀ ਹੈ ਇੱਥੇ ਹਰ ਤਰ੍ਹਾਂ ਦੇ ਮੇਲੇ ਲੱਗਦੇ ਆ ਵਿਸਾਖੀ ਮੇਲਾ ਮੇਲਾ ਲੱਗਦਾ ਉੱਥੇ ਕਿੰਨਾ ਨੇ ਬੱਚੇ ਜਾਂਦੇ ਹਾਂ ਅਸੀਂ ਜਾਂਦੇ ਹਾਂ ਔਰ ਪੀਰਾਂ ਦੇ ਸਾਰੇ ਪੰਡੋਰੀ ਧਾਮ ਉੱਥੇ ਮੇਲੇ ਲੱਗਦੇ ਆ ਔਰ ਸੱਭਿਆਚਾਰ ਉੱਥੇ ਕਿੰਨਾਂ ਨੇ ਮੇਲਾ ਲੱਗਦਾ ਬੱਬੇ ਹਾਲੀ ਛਿੰਝ ਉੱਥੇ ਮੇਲਾ ਲੱਗਦਾ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਾਂ ਉੱਥੇ ਬੱਚੇ ਝੂਟੇ ਲੈਂਦੇ ਹੈ ਖੇ ਖੇਡਦੇ ਹੈ ਖਾਂਦੇ ਪੀਂਦੇ ਆ ਉੱਥੇ ਜਲੇਬੀਆਂ ਜਲੂਬੀਆਂ ਸ ਪਕੌੜੇ ਵਗੈਰਾ ਸਾਰਾ ਕੁਛ ਖਾਂਦੇ ਆ ਅਤੇ ਉਹ ਸਾਰਾ ਕੁਛ ਉਹ ਕਰਦੇ ਆ ਕਿੰਨਾਂ ਨੇ ਬੜੇ ਖੁਸ਼ੀ ਹੁੰਦੀ ਆ ਸਾਡਾ ਸਾਲ ਸਾਲ ਬਾਅਦ ਆਉਂਦਾ ਸਾਲ ਬਾਅਦ ਅਸੀਂ ਸਾਰੇ ਹੀ ਜਾਂਦੇ ਹਾਂ ਬੱਚਿਆਂ ਨੂੰ ਨਾਲ ਲੈ ਕੇ ਫਿਰ ਘਰ ਵੀ ਅਸੀਂ ਲੈ ਕੇ ਆਉਂਦੇ ਹਾਂ ਜਲੇਬੀਆਂ ਪਕੌੜੇ ਬੱਚਿਆਂ ਵਾਸਤੇ ਜੋ ਜੋ ਝੂਟੇ ਬੱਚੇ ਕਹਿੰਦੇ ਅਸੀਂ ਲੈਣੇ ਬੱਚਿਆਂ ਨੂੰ ਝੂਟੇ ਵੀ ਦਿਵਾਉਂਦੇ ਹਾਂ ਸਾਰੇ ਪਾਸੇ ਅਸੀਂ ਉਹ ਕਰਦੇ ਹਾਂ ਅਸੀਂ ਉਹਨਾਂ ਨੂੰ ਸਾਰਾ ਕਿੱਦਾਂ ਨਹੀਂ ਕਰਨਾ ਸਾਡੇ ਬੜੇ ਮੇਲੇ ਲੱਗਦੇ ਹੈ ਅਤੇ ਕਦੀ ਪੰਡੋਰੀ ਲੱਗ ਗਿਆ ਕਦੀ ਕਿੰਨਾਂ ਨੇ ਤਿਬੜੀ ਮੇਲਾ ਲੱਗ ਗਿਆ ਸਾਰੇ ਮੇਲੇ ਵਿਸਾਖੀ ਦੇ ਮੇਲੇ ਉਦਾਂ ਵੀ ਲੱਗਦੇ ਪੀਰਾਂ ਦੇ ਜਗ੍ਹਾ ਦੇ ਉੱਤੇ ਸਾਰਿਆਂ ਪਾਸੇ ਮੇਲੇ ਲੱਗਦੇ ਅਤੇ ਅਸੀਂ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਇਹ ਮੇਲਿਆਂ ਦਾ ਬਹੁਤ ਵਧੀਆ ਸਾਲ ਬਾਅਦ ਆਉਂਦਾ ਦਿਨ ਸਾਨੂੰ ਬਹੁਤ ਅੱਛਾ ਲੱਗਦਾ ਬਹੁਤ ਚੰਗਾ ਲੱਗਦਾ ਅਸੀਂ ਜਾਂਦੇ ਹਾਂ ਮਨ ਨੂੰ ਖੁਸ਼ੀ ਹੁੰਦੀ ਹੈ ਘੁੰਮ ਫਿਰ ਕੇ ਆਉਂਦੇ ਹਾਂ ਅਤੇ ਬਹੁਤ ਜ਼ਿਆਦਾ ਸਾਡਾ ਕਿੰਨਾ ਨਹੀਂ ਉਹ ਹੁੰਦਾ ਵਾ ਕਿੰਨਾ ਨਹੀਂ ਬੱਚਿਆਂ ਦਾ ਕਿੰਨਾ ਨਹੀਂ ਬਹੁਤ ਜ਼ਿਆਦਾ ਕਿੰਨਾ ਨਹੀਂ ਕਰਦੇ ਹਾਂ ਅਸੀਂ ਔਰ ਕੀ ਕਹਿੰਦੇ ਨੇ ਬੱਚਿਆਂ ਨੂੰ ਖੁਸ਼ੀ ਐਨੀ ਹੁੰਦੀ ਆ ਬੜੇ ਖੁਸ਼ ਹੁੰਦੇ ਆ ਬੱਚੇ ਕਿੰਨਾਂ ਨੀ ਖੇਡਦੇ ਆ ਬੜੇ ਘਰ ਵੀ ਕਾਂਦੇ ਆ ਕਹਿੰਦੇ ਆ ਬ ਕੀ ਲੈ ਕੇ ਆਏ ਉੱਥੇ ਕੀ ਦੇਖਿਆ ਭੰਗੂੜੇ ਫਿਰ ਖਿਡੌਣੇ ਬੱਚਿਆਂ ਨੂੰ ਬੜਾ ਖੁਸ਼ ਲੈਂਦੇ ਆ ਬੱਚੇ ਜਾਂਦੇ ਆ ਇਹ ਲੈ ਦਿਓ ਸਾਨੂੰ ਇਹ ਲੈ ਦਿਓ ਬੜਾ ਕਿਤੇ ਨਹੀਂ ਮਨ ਖੁਸ਼ ਹੁੰਦਾ ਬੱਚੇ ਘੁੰਮਦੇ ਫਿਰਦੇ ਆ ਅਸੀਂ ਵੀ ਘੁੰਮਦੇ ਫਿਰਦੇ ਹਾਂ ਹੋਰ ਕੀ